ਸਤਿ ਸ਼੍ਰੀ ਅਕਾਲ ਜੀ ਭੰਗੜਾ ਐਰੋਬਿਕਸ ਵਿੱਚ ਹਿੱਸਾ ਲੈਣ ਲਈ ਅਸੀਂ ਮਾਨਸਿਕ ਅਤੇ ਸਰੀਰਕ ਕਸਰਤ ਕਰ ਸਕਦੇ ਹਾਂ ਇਹਦੇ ਨਾਲ ਸਾਡਾ ਸਰੀਰ ਅਤੇ ਦਿਮਾਗ ਫਰੀ ਫਰੀ ਮਹਿਸੂਸ ਕਰਦਾ ਕਿ ਅਸੀਂ ਰਿਲੈਕਸ ਮਹਿਸੂਸ ਕਰਦੇ ਹਾਂ ਸ਼ਾ ਮਾਨਸਿਕ ਸ਼ਾਂਤੀ ਮਿਲਦੀ ਸਾਨੂੰ ਇਸ ਕਰਕੇ ਸਰੀਰ ਵੀ ਸਹੀ ਰਹਿੰਦਾ ਹੈ ਇਹਦੇ ਨਾਲ ਅੱਜ ਕੱਲ੍ਹ ਤਾਂ ਘਰਾਂ ਦੇ ਵਿੱਚ ਇੰਨੀ ਕਸਰਤ ਨਹੀਂ ਹੁੰਦੀ ਜਿੱਦਾਂ ਅਸੀਂ ਪਹਿਲਾਂ ਸਾਰੇ ਕੰਮ ਹੱਥਾਂ ਨਾਲ ਕਰਦੇ ਸੀ ਅੱਜ ਕੱਲ੍ਹ ਸਾਰੇ ਹਰ ਕੰਮ ਸੌਖਾ ਹੋ ਗਿਆ ਇਸ ਕਰਕੇ ਸਾਨੂੰ ਭੰਗੜਾ ਅਤੇ ਐਰੋਬਿਕਸ ਕਰਨ ਵਿੱਚ ਕਦੇ ਕਦੇ ਬਾਹਰ ਜਾਣ ਬਾਹਰ ਜਾਣਾ ਪੈਂਦਾ ਕਦੇ ਕਈ ਕੇਂਦਰ ਵੀ ਖੁੱਲ੍ਹੇ ਹੋਏ ਨੇ ਅਤੇ ਉੱਥੇ ਜਾ ਕੇ ਅਸੀਂ ਆਪਣਾ ਸ਼ ਮਾਨਸਿਕ ਅਤੇ ਸਰੀਰ ਨੂੰ ਸ਼ਾਂਤੀ ਮਿਲਦੀ ਹੈ ਭੰਗੜਾ ਅਤੇ ਐਰੋਬਿਕਸ ਕਰਨ ਦੇ ਨਾਲ ਅਸੀਂ ਬਹੁਤ ਵਧੀਆ ਮਹਿਸੂਸ ਕਰਦੇ ਹਾਂ ਇਹਦੇ ਨਾਲ ਅਤੇ ਬਹੁਤ ਵਧੀਆ ਲੱਗਦਾ ਹੈ ਸਰੀਰ ਵੀ ਹਲਕਾ ਫੁਲਕਾ ਅਤੇ ਟੈਂਸ਼ਨ ਫਰੀ ਲੱਗਦਾ ਬਹੁਤ ਵਧੀਆ ਕਸਰਤ ਹੁੰਦੀ ਹੈ ਭੰਗੜੇ ਅਤੇ ਅਰੋਬਿਕਸ ਵਿੱਚ ਅਤੇ ਸਰੀਰ ਵੀ ਵਧੀਆ ਹੋ ਜਾਂਦਾ ਅਤੇ ਬਹੁਤ ਵਧੀਆ ਲੱਗਦਾ ਇਸ ਕਰਕੇ ਸਾਨੂੰ ਭੰਗੜਾ ਅਤੇ ਅਰੋਬਿਕਸ ਵਿੱਚ ਹਿੱਸਾ ਲੈਣਾ ਬਹੁਤ ਵਧੀਆ ਬਹੁਤ ਜ਼ਰੂਰੀ ਆ ਅੱਜ ਕੱਲ੍ਹ ਦੇ ਜ਼ਮਾਨੇ 'ਚ ਅੱਜ ਕੱਲ੍ਹ ਸਰੀਰ ਬਹੁਤ ਵਧੀਆ ਰਹਿੰਦਾ ਇਹ ਸਭ ਕਰਕੇ ਅਤੇ ਸਾਨੂੰ ਹਰ ਇੱਕ ਨੂੰ ਭੰਗੜਾ ਅਤੇ ਅਰੋਬਿਕਸ ਵਿੱਚ ਹਿੱਸਾ ਲੈਣਾ ਚਾਹੀਦਾ ਇਹਦੇ ਨਾਲ ਸਾਡਾ ਸਰੀਰ ਅਤੇ ਮਾਨਸਿਕ ਸ਼ਾ ਸਰੀਰਕ ਅਤੇ ਮਾਨਸਿਕ ਸ਼ਾਂਤੀ ਮਿਲਦੀ ਹੈ